ਸਾਡੇ ਪੰਜਾਬੀ ਸੱਭਿਆਚਾਰ ਵਿੱਚ ਬਹੁਤ ਸਾਰੀਆਂ ਕਲਾਵਾਂ ਪਰੰਪਰਾਵਾਂ ਲੋਕਾਂ ਵਿੱਚ ਪ੍ਰਚੱਲਿਤ ਹਨ ਜਿਵੇਂ ਕਿ ਜਨਮ ਮਰਨ ਵਿਆਹ ਦੇ ਸਮੇਂ ਬਹੁਤ ਸਾਰੀਆਂ ਲੋਕਾਂ ਦੀਆਂ ਪਰੰਪਰਾਵਾਂ ਕੀਤੀਆਂ ਜਾਂਦੀਆਂ ਹਨ ਜਿਵੇਂ ਕਿ ਜਦੋਂ ਮੰਨ ਲਓ ਜਦੋਂ ਕਿ ਵਿਆਹ ਹੁੰਦਾ ਤਾਂ ਉਦੋਂ ਇੱਕ ਪਰੰਪਰਾ ਦੇ ਰੂਪ ਵਿੱਚ ਹੀ ਭੈਣ ਆਪਦੇ ਭਰਾ ਦੇ ਸਿਹਰਾ ਬੰਨ੍ਹਦੀ ਹੈ ਅਤੇ ਮਾਤਾ ਆਪਦੇ ਪੁੱਤਰ ਪੁੱਤਰ ਉੱਪਰ ਦੀ ਪਾਣੀ ਵਾਰਦੀ ਆ ਅਤੇ ਉਸ ਤੋਂ ਬਾਅਦ ਜਿਹੜੀਆਂ ਭਰਜਾਈਆਂ ਨੇ ਉਹ ਉਹਦੇ ਸੁਰਮਾਂ ਪਾਉਂਦੀਆਂ ਨੇ ਸਾਡੇ ਜਿਹੜੇ ਲੋਕ ਨੇ ਉਹ ਇਹਨਾਂ ਨਾਲ ਜੁੜੇ ਹੋਏ ਨੇ ਅਤੇ ਸੱਭਿਆਚਾਰ ਦੇ ਵਿੱਚ ਜਿਹੜਾ ਇਹ ਹੈਗਾ ਵੀ ਜਿੰਨੀਆਂ ਵੀ ਰਸਮਾਂ ਰੀਤਾਂ ਨੇ ਲੋਕ ਅੱਜ ਵੀ ਸੱਭਿਆਚਾਰ ਨਾਲ ਜੁੜੇ ਹੋਏ ਨੇ ਸਾਡਾ ਸੱਭਿਆਚਾਰ ਬਹੁਤ ਅਮੀਰ ਆ ਅਤੇ ਅਸੀਂ ਇਸ ਨੂੰ ਬਹੁਤ ਉੱਪਰ ਤੱਕ ਲਿਜਾ ਸਕਦੇ ਹਾਂ ਇਹਦੇ ਵਿੱਚ ਜਿਵੇਂ ਮੌਤ ਦੀਆਂ ਰਸਮਾਂ ਦੇ ਵਿੱਚ ਜਦੋਂ ਕੋਈ ਬੰਦੇ ਦੀ ਡੈਥ ਹੋ ਜਾਂਦੀ ਹੈ ਤਾਂ ਸਾਰੇ ਡਾਹ ਕੇ ਬਹਿ ਜਾਂਦੇ ਆ ਉਹ ਰਲ ਮਿਲ ਜਾਂਦੇ ਆ ਵੀ ਉਹ ਇੱਕ ਸੱਭਿਆਚਾਰ ਆ ਲੋਕ ਵਰਤਾਰਾ ਜਿਹਦੇ ਵਿੱਚ ਸਾਡੀ ਲੋਕ ਧਾਰਾ ਵੀ ਸ਼ਾਮਿਲ ਹੁੰਦੀ ਹੈ ਇਸ ਤੋਂ ਬਾਅਦ ਜਦੋਂ ਕਿਸੇ ਦਾ ਜਨਮ ਹੁੰਦਾ ਜਨਮ ਦੇ ਵੇਲੇ ਵੀ ਸਾਰੇ ਘਰ ਆਪਸ ਵਿੱਚ ਰਲ ਕੇ ਜਿਵੇਂ ਕਿ ਪਹਿਲਾਂ ਆਪਾਂ ਕਹਿ ਦਿੰਦੇ ਹਾਂ ਸ਼ਰੀਂਹ ਬੰਨ੍ਹਦੇ ਨੇ ਜਾਂ ਉਹ ਨਿੰਮ ਬੰਨ੍ਹਦੇ ਨੇ ਇਹਦੇ ਵਿੱਚ ਵੀ ਜਿਹੜੀ ਸਾਡਾ ਪੰਜਾਬੀ ਸੱਭਿਆਚਾਰ ਆ ਲੋਕਾਂ ਦਾ ਇਕੱਠ ਆ ਲੋਕਾਂ ਦੀ ਆਮ ਉਹਨਾਂ ਦੀਆਂ ਪਿੱਛੋਂ ਪੀੜ੍ਹੀ ਦਰ ਪੀੜ੍ਹੀ ਚੱਲੀਆਂ ਪਰੰਪਰਾਵਾਂ ਚੱਲੀਆਂ ਆਉਂਦੀਆਂ ਨੇ ਉਹਦੇ ਅਨੁਸਾਰ ਹੀ ਜਿਹੜਾ ਸਮਾਜ ਵਿੱਚ ਆਪਦਾ ਜੀਵਨ ਬਿਤਾਉਂਦੇ ਆ ਅਤੇ ਇਸ ਕਰਕੇ ਲੋਕ ਪਰੰਪਰਾ ਵਿੱਚ ਜਨਮ ਦੇ ਨਾਲ ਸੰਬੰਧਿਤ ਵਿਆਹ ਦੇ ਨਾਲ ਸੰਬੰਧਿਤ ਮੌਤ ਦੇ ਨਾਲ ਸੰਬੰਧਿਤ ਬਹੁਤ ਸਾਰੀਆਂ ਰੀਤਾਂ ਰਸਮਾਂ ਕੀਤੀਆਂ ਜਾਂਦੀਆਂ ਹਨ ਜਿਹਦੇ ਨਾਲ ਅਸੀਂ ਅੱਜ ਵੀ ਜੁੜੇ ਹੋਏ ਹਾਂ